ਮੇਰੇ ਮਨ ਪਸੰਦੀਦਾ ਪੰਜਾਬੀ ਕਵੀ ਦਾ ਨਾਮ ਹੈ ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਬਟਾਲਵੀ ਪੰਜ ਪਾਕਿਸਤਾਨ ਦੇ ਜੰਮੇ ਪਲੇ ਨੇ ਅਤੇ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਡੂੰਗਾਈ ਹੁੰਦੀ ਹੈ ਮੈਂ ਅਕਸਰ ਹੀ ਇਹਨਾਂ ਦੀਆਂ ਕਵਿਤਾਵਾਂ ਪੜ੍ਹਦੀ ਰਹਿੰਦੀ ਹਾਂ ਜਦੋਂ ਵੀ ਮੈਂ ਕਿਤੇ ਇਕੱਲਾ ਫੀਲ ਕਰਾਂ ਜਾਂ ਫਿਰ ਮੈਂ ਉਦਾਸ ਹੋਵਾਂ ਤਾਂ ਇਹਨਾਂ ਦੀਆਂ ਕਵਿਤਾਵਾਂ ਮੈਨੂੰ ਅਲੱਗ ਤੋਂ ਹੀ ਇੱਕ ਜੋਸ਼ ਦੇ ਦਿੰਦੀਆਂ ਹਨ ਜਿੱਦਾਂ ਕਿ ਇਹਨਾਂ ਦੀਆਂ ਕਈ ਕਿਤਾਬਾਂ ਵੀ ਹਨ ਜਿਹੜੀਆਂ ਮੈਂ ਪੜ੍ਹੀਆਂ ਨੇ ਜਿਵੇਂ ਬਿਰਹਾ ਤੂੰ ਸੁਲਤਾਨ ਲੂਣਾ ਜਿਹਨਾਂ ਦੇ ਵਿੱਚ ਕਿ ਇਹਨਾਂ ਦਾ ਲੂਣਾ ਦਾ ਚਰਿੱਤਰ ਬਹੁਤ ਹੀ ਬਾਖੂਬੀ ਦੱਸਿਆ ਗਿਆ ਹੈ ਸ਼ਿਵ ਕੁਮਾਰ ਬਟਾਲਵੀ ਨੂੰ ਪਦਮ ਭੂਸ਼ਣ ਅਵੋਰਡ ਵੀ ਦਿੱਤਾ ਗਿਆ ਹੈ ਕਿਉਂਕਿ ਇਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਹੁੰਦੀਆਂ ਨੇ ਬਹੁਤ ਹੀ ਡੂੰਘਾਈ ਵਾਲੀਆਂ ਹੁੰਦੀਆਂ ਨੇ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਅਸਲੀਅਤ ਨੂੰ ਬਿਆਨ ਕੀਤਾ ਹੁੰਦਾ ਹੈ ਕਵਿਤਾਵਾਂ ਦੇ ਵਿੱਚ ਪੰਜਾਬੀ ਦੇ ਮਸ਼ਹੂਰ ਕਵੀ ਸ਼ਿਵ ਕੁਮਾਰ ਬਟਾਲਵੀ ਇੱਕ ਤਰ੍ਹਾਂ ਸਭਨਾਂ ਦੀ ਹੀ ਜਾਨ ਹਨ ਕਿਉਂਕਿ ਇਹਨਾਂ ਦੀਆਂ ਕਵਿਤਾਵਾਂ ਸਾਰਿਆਂ ਦੇ ਵਿੱਚ ਇੱਕ ਅਲੱਗ ਤੋਂ ਹੀ ਰੋਮਾਂਚ ਜਗਾ ਦਿੰਦੀਆਂ ਹਨ ਕਈ ਕਵਿਤਾਵਾਂ ਤਾਂ ਇਹਨਾਂ ਦੀਆਂ ਰੋਮੈਂਟਿਕ ਵੀ ਹੁੰਦੀਆਂ ਨੇ ਅਤੇ ਕਈ ਉਦਾਸੀ ਭਰੀਆਂ ਕਵਿਤਾਵਾਂ ਵੀ ਹੁੰਦੀਆਂ ਹਨ ਦੁਨੀਆਦਾਰੀ ਨੂੰ ਬਾਖੂਬੀ ਇਹ ਆਪਣੀ ਕਵਿਤਾਵਾਂ ਦੇ ਵਿੱਚ ਨਿਖਾਰਦੇ ਨੇ